ਆਪਾਂ ਗੱਲ ਕਰਨ ਜਾ ਰਹੇ ਤੈਕਨੋਲੋਜੀ ਨੇ ਪਰਿਵਾਰਿਕ ਜੀਵਨ ਅਤੇ ਜੀਵਨ ਸ਼ੈਲੀ ਨੂੰ ਕਿਵੇਂ ਰੋਕਿਆ ਹੈ ਹੁਣ ਆਪਾਂ ਸਿੰਪਲੀ ਆਪਾਂ ਅੱਜ ਕੱਲ੍ਹ ਦੀ ਗੱਲ ਕਰ ਲਈਏ ਜੇ ਘਰ 'ਚ ਪੰਜ ਜੀਅ ਨੇ ਅਤੇ ਪੰਜਾਂ ਕੋਲ ਸਮਾਰਟਫੋਨ ਹੈਗਾ ਹਰ ਇਕ ਕੋਲ ਹਰ ਕਿਸੇ ਫੋਨ 'ਤੇ ਵਾਈਫਾਈ ਚਲਦਾ ਇੰਟਰਨੈਟ ਚਲਦਾ ਅੱਜ ਕੱਲ੍ਹ ਫਾਈਵ ਜੀ ਇੰਟਰਨੈਟ ਆ ਗਏ ਨੇ ਅਤੇ ਇਹਦੇ ਨਾਲ ਕੀ ਹੈ ਕਿ ਪਰਿਵਾਰ ਥੋੜ੍ਹਾ ਅਲੱਗ ਅਲੱਗ ਵੱਖਰਾ ਵੱਖਰਾ ਰਹਿਣ ਲੱਗ ਪੈਂਦਾ ਪੰਜਾਂ ਕੋਲ ਫੋਨ ਅਤੇ ਪੰਜ ਉਹਦੇ ਜੀਅ ਵਿਅਸਤ ਨੇ ਸਾਰੇ ਅਤੇ ਹੋਰ ਕੀ ਹੈ ਕਿ ਜੀਵਨ ਸ਼ੈਲੀ 'ਚ ਕਿਵੇਂ ਫਰਕ ਪਾਇਆ ਕਿ ਪਹਿਲੇ ਦੇ ਜ਼ਮਾਨੇ ਵਿੱਚ ਆਪਾਂ ਨੂੰ ਕਿਤੇ ਕੋਂਮਨੀਕੇਟ ਜਾਂ ਫਿਰ ਕਿਤੇ ਕੋਂਟੈਕਟ ਕਰਨਾ ਹੁੰਦਾ ਸੀ ਤਾਂ ਅਸੀਂ ਚਿੱਠੀ ਜਾਂ ਪੱਤਰ ਦੇ ਰਾਹੀਂ ਕਰਦੇ ਸੀ ਪਰ ਹੁਣ ਕਿਵੇਂ ਹੋ ਗਿਆ ਕਿ ਕਿੰਨਾ ਈਜ਼ੀ ਹੋ ਗਿਆ ਕਿ ਅੱਜ ਕੱਲ੍ਹ ਵੀਡੀਓ ਕਾਲ ਅਵੇਲੇਬਲ ਹੈ ਵਟਸਅਪ 'ਤੇ ਆਪਾਂ ਵੀਡੀਓ ਕਾਲ ਕਰ ਸਕਦੇ ਹਾਂ ਲੈਪਟਾਪ 'ਤੇ ਆਪਾਂ ਵੀਡੀਓ ਕਾਲ ਕਰ ਸਕਦੇ ਹਾਂ ਇਹਦੇ ਨਾਲ ਜੀਵਨ ਸ਼ੈਲੀ ਵਿੱਚ ਬਹੁਤ ਜ਼ਿਆਦਾ ਫਰਕ ਆਇਆ ਹੈ ਘਰ ਵਿੱਚ ਆਪਾਂ ਹੌਲੀ ਹੌਲੀ ਇੱਕ ਦੂਜੇ ਦੂਰ ਹੋਈ ਜਾਂਦੇ ਹਾਂ ਇਸ ਤਰ੍ਹਾਂ ਨਾਲ ਜੀਵਨ ਸ਼ੈਲੀ ਦੇ ਵਿੱਚ ਫਰਕ ਆ ਗਿਆ ਬਹੁਤ ਜ਼ਿਆਦਾ ਹੋਰ ਵੀ ਕਈ ਸਾਰੀਆਂ ਚੀਜ਼ਾਂ ਹੈਗੀਆਂ ਕਈ ਸਾਰੀਆਂ ਐਪਸ ਹੈਗੀਆਂ ਆ ਜਿਹੜੇ ਫੋਨ ਆਪਾਂ ਸਾਰਾ ਦਿਨ ਯੂਸ ਕਰਦੇ ਰਹਿੰਦੇ ਹਾਂ ਜਿਹੜੇ ਆਪਣੇ ਪਰਿਵਾਰਿਕ ਜੀਵਨ ਨੂੰ ਰੋਕ ਦਿੰਦੀ ਹੈ ਉਹਨੂੰ ਅਸਤ ਵਿਅਸਤ ਕਰ ਦਿੰਦੀ ਹੈ ਥੈਂਕ ਯੂ ਜੀ